ਮੈਂ ਫਤਿਹਗੜ੍ਹ ਸਾਹਿਬ ਦੀ ਵਸਨੀਕ ਹਾਂ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਰਹਿੰਦੀ ਹਾਂ ਕਿਉਂਕਿ ਇੱਥੇ ਨਿੱਕੀਆਂ ਜ਼ਿੰਦਾਂ ਅਤੇ ਵੱਡੇ ਸਾਕੇ ਹੋਏ ਹਨ ਪਰ ਇੱਥੇ ਰਾਜਨੀਤਿਕ ਮਾਮਲਿਆਂ ਵਿੱਚ ਚੁਣੌਤੀਆਂ ਆਉਂਦੀਆਂ ਹਨ ਜਿਵੇਂ ਕਿ ਇੱਥੇ ਕੁਝ ਬਹੁਤ ਬੁੱਤ ਬਣਨੇ ਸੀ ਉਹ ਦੋ ਵਿਰੋਧੀ ਪਾਰਟੀਆਂ ਦੇ ਕਾਰਨ ਉਹ ਬੁੱਤ ਨਹੀਂ ਬਣ ਸਕੇ ਜਿਸ ਨਾਲ਼ ਫਤਿਹਗੜ੍ਹ ਸਾਹਿਬ ਦੀ ਦਿੱਖ ਬਹੁਤ ਵਧੀਆ ਹੋ ਜਾਣੀ ਸੀ ਜੇਕਰ ਧਾਰਮਿਕ ਯੋਧਿਆਂ ਦੇ ਬੁੱਤ ਲੱਗਣੇ ਸੀ ਜਿਸ ਨਾਲ਼ ਫਤਿਹਗੜ੍ਹ ਸਾਹਿਬ ਦੀ ਸੁੰਦਰੀਕਰਨ ਹੋਰ ਵੀ ਵਧੀਆ ਹੋ ਜਾਣਾ ਸੀ ਇੱਕ ਧਾਰਮਿਕ ਧਰਤੀ ਹੈ ਇੱਥੇ ਅਤੇ ਇੱਥੇ ਮੀਟ ਅਤੇ ਸ਼ਰਾਬ ਦੇ ਠੇਕੇ ਨਹੀਂ ਹੋਣੇ ਚਾਹੀਦੇ ਵਿਰੋਧੀਆਂ ਪਾਰਟੀਆਂ ਦੇ ਕਰਕੇ ਜੋ ਮਿਊਜ਼ੀਅਮ ਦਾ ਕੰਮ ਰੁਕਿਆ ਹੋਇਆ ਹੈ ਉਸ ਨੂੰ ਪੂਰਾ ਕੀਤਾ ਜਾਵੇ ਸਰਕਾਰਾਂ ਜੋ ਕਿਸਾਨਾਂ ਨਾਲ਼ ਝੂਠੇ ਵਾਅਦੇ ਕਰਦੀਆਂ ਹਨ ਉਹਨਾਂ ਕਰਕੇ ਕਿਸਾਨਾਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਸਰਕਾਰਾਂ ਕਿਸਾਨਾਂ ਨਾਲ਼ ਝੂਠੇ ਵਾਅਦੇ ਨਾ ਕਰਨ ਅਤੇ ਤਾਂ ਉਹਨਾਂ ਨੂੰ ਆਪਣੀਆਂ ਜਾਨਾਂ ਨਾ ਗਵਾਉਣੀਆਂ ਪੈਣ